ਸਾਈਕਲ ਚਲਾਉਣਾ ਬਹੁਤ ਹੀ ਵਧੀਆ ਕਿਰਿਆ ਹੈਗੀ ਹੈ ਸਿਹਤ ਵਾਸਤੇ ਕਿਉਂਕਿ ਸਾਈਕਲ ਚਲਾਉਣ ਨਾਲ ਆਪਣਾ ਜਿਹੜਾ ਸਰੀਰ ਹੈ ਉਹ ਸੁਚਾਰੂ ਰੂਪ ਨਾਲ ਚਲਦਾ ਰਹਿੰਦਾ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਆਪ ਨੂੰ ਆਪਾਂ ਸਿਹਤਮੰਦ ਰੱਖ ਸਕਦੇ ਹਾਂ ਅਤੇ ਦੂਜਾ ਜਿਹੜਾ ਹੈਗਾ ਸਾਈਕਲ ਦੀ ਦੇਖਭਾਲ ਮੈਂ ਬਹੁਤ ਵਧੀਆ ਕਰਦੀ ਹਾਂ ਜਿਵੇਂ ਉਸ ਨੂੰ ਜਦੋਂ ਵੀ ਮੇਰੀ ਛੁੱਟੀ ਹੋਈ ਉਸ ਦਿਨ ਮੈਂ ਆਪਣੇ ਸਾਈਕਲ ਨੂੰ ਸਾਫ ਕਰਦੀ ਹਾਂ ਫਿਰ ਉਸ ਨੂੰ ਜਿਹੜਾ ਕੋਈ ਰਿਪੇਅਰਮੈਂਟ ਦੀ ਜ਼ਰੂਰਤ ਹੋਵੇ ਉਹ ਸਾਈਕਲ ਵਾਲੇ ਤੋਂ ਉਹ ਵੀ ਕਰਵਾ ਕੇ ਲਿਉਂਦੀ ਹਾਂ ਤਾਂ ਕਿ ਕਿਸੇ ਲੰਬੇ ਰੂਟ 'ਤੇ ਜਾਣਾ ਪਵੇ ਤਾਂ ਰਾਸਤੇ ਵਿੱਚ ਕੋਈ ਦਿੱਕਤ ਨਾ ਆਵੇ ਕੋਈ ਪ੍ਰੋਬਲਮ ਨਾ ਆਵੇ ਅਤੇ ਇਸ ਦੇ ਨਾਲ ਹੀ ਸਾਈਕਲ ਜਿਹੜੀ ਹੈਗੀ ਆ ਮੈਂ ਇਸ ਕਰਕੇ ਖਰੀਦੀ ਹੈ ਤਾਂ ਕਿ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਵੱਡੇ ਵੱਡੇ ਲੋਕਾਂ ਨੇ ਗੱਡੀਆਂ ਛੱਡ ਕੇ ਸਾਈਕਲਾਂ ਫੜ ਲਈਆਂ ਕਿਉਂਕਿ ਉਹਨਾਂ ਨੂੰ ਸਰੀਰ ਦੀ ਲੋੜ ਹੈ ਅਸਲ ਦੇ ਵਿੱਚ ਆਪਾਂ ਨੂੰ ਇੱਕ ਆਰਾਮਦਾਇਕ ਜ਼ਿੰਦਗੀ ਮਿਲ ਰਹੀ ਹੈ ਤਾਂ ਆਪਾਂ ਬਿਲਕੁਲ ਵੀ ਔਖੇ ਨਹੀਂ ਹੋਣਾ ਚਾਹੁੰਦੇ ਸਾਈਕਲ ਨੂੰ ਚਲਾਉਣਾ ਔਖਾ ਹੈ ਜਦ ਕਿ ਗੱਡੀ ਨੂੰ ਚਲਾਉਣਾ ਬਹੁਤ ਸੌਖਾ ਪਰ ਜਿਹੜੀ ਸੁਖਿਆਈ ਹੈ ਉਹ ਆਪਣੇ ਸਰੀਰ ਨੂੰ ਹੱਡ ਹਰਾਮੀ ਦੇ ਰਹੀ ਹੈ ਅਤੇ ਜਿਹੜੀ ਸਾਈਕਲ ਹੈ ਉਹ ਆਪਾਂ ਨੂੰ ਤੰਦਰੁਸਤੀ ਦੇ ਰਹੀ ਹੈ